ਮੇਰਾ ਪਸੰਦੀਦਾ ਗੀਤ ਮੈਂ ਅੱਜ ਕੱਲ੍ਹ ਪਸੰਦੀਦਾ ਗੀਤ ਤਾਂ ਬਹੁਤ ਸਾਰੇ ਨੇ ਮਗਰ ਇੱਕ ਗੀਤ ਹੈ ਜੋ ਮੇਰੇ ਦਿਲ ਦੇ ਨੇੜੇ ਨੇ ਕਿਉਂਕਿ ਇਹ ਗੀਤ ਮੈਂ ਆਪਣੇ ਮਾਂ ਪਿਓ ਨਾਲ ਸੁਣਦੀ ਹਾਂ ਤਾਂ ਸਾਡੀਆਂ ਅੱਖਾਂ ਭਰ ਆਉਂਦੀਆਂ ਨੇ ਗੀਤ ਕੁਛ ਇਸ ਪ੍ਰਕਾਰ ਹੈ

ਇਹ ਗਾਣਾ ਜਦੋਂ ਵੀ ਮੈਂ ਆਪਣੇ ਪਾਪਾ ਨਾਲ ਸੁਣਦੀ ਹਾਂ ਤਾਂ ਉਹ ਮੇਰੇ ਵੱਲ ਦੇਖ ਕੇ ਅੱਖਾਂ ਭਰ ਲੈਂਦੇ ਨੇ ਕਿਉਂਕਿ ਪਿਓ ਆਪਣੀਆਂ ਧੀਆਂ ਦੇ ਬੜੇ ਨੇੜੇ ਹੁੰਦਾ ਹੈ ਤਾਂ ਉਸ ਨੂੰ ਸਾਰੀ ਉਮਰ ਇਹ ਗੱਲ ਦਾ ਡਰ ਲੱਗਿਆ ਰਹਿੰਦਾ ਹੈ ਕਿ ਇੱਕ ਨਾ ਇੱਕ ਦਿਨ ਮੇਰੀ ਧੀ ਨੇ ਮੇਰੇ ਤੋਂ ਵੱਖ ਹੋ ਕੇ ਮੇਰੇ ਤੋਂ ਵਿਦਾ ਹੋ ਕੇ ਦੂਸਰੇ ਘਰ ਚਲੇ ਜਾਣਾ ਹੈ ਇਸ ਕਰਕੇ ਇਹ ਗਾਣਾ ਮੇਰੇ ਦਿਲ ਦੇ ਬਹੁਤ ਨੇੜੇ ਹੈ ਅੱਜ ਵੀ ਇਸ ਗਾਣੇ ਦੀ ਗੱਲ ਕਰਦੇ ਹੋਏ ਮੈਂ ਬੜੀ ਭਾਵੁਕ ਹੋ ਗਈ ਹਾਂ